ਸਥਾਨਕ ਸਮਾਗਮਾਂ ਤੋਂ ਪਹਿਲਾਂ ਡੀਸੀ ਦਫਤਰ ਜਾਂ ਪ੍ਰਸ਼ਾਸਨ ਵੱਲੋਂ ਸਾਰੇ ਸਕੂਲਾਂ ਦੇ ਵਿੱਚ ਕੋਲੇਜਾਂ ਦੇ ਵਿੱਚ ਜਾਂ ਹੋਰ ਲੋਕਲ ਜਥੇਬੰਦੀਆਂ ਵਿੱਚ ਨੋਟੀਸ ਭੇਜਿਆ ਜਾਂਦਾ ਹੈ ਫਿਰ ਉਸ ਤੋਂ ਬਾਅਦ ਕੋਈ ਵੀ ਸਥਾਨਕ ਸਮਾਗਮ ਵੇਲੇ ਸਾਰੇ ਸਥਾਨਕ ਜਿਵੇਂ ਲੋਕ ਜੇ ਜਾਂ ਲੋਕਲ ਜੋ ਜਨਤਾ ਹੁੰਦੀ ਆ ਉਹਨਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਉੱਥੇ ਪਹੁੰਚਣ ਦੇ ਲਈ ਹੋਰ ਪ੍ਰਬੰਧ ਕੀਤੇ ਜਾਂਦੇ ਨੇ ਜਿਵੇਂ ਕਿ ਟ੍ਰੈਫਿਕ ਕੰਟਰੋਲ ਜਾਂ ਟ੍ਰੈਫਿਕ ਡਾਇਵਰਟ ਕਰਨ ਦਾ ਪ੍ਰਬੰਧ ਅਤੇ ਹੋਰ ਸਥਾਨਕ ਪ੍ਰਬੰਧ ਥੋੜ੍ਹੇ ਦਿਨ ਪਹਿਲਾਂ ਹੀ ਸਾਡੇ ਸਥਾਨੀ ਪੁਲਿਸ ਨੇ ਡਰੱਗਸ ਦੀ ਜਾਗਰੂਤਾ ਲਈ ਮੈਰਾਥੋਨ ਦੌੜ ਕਰਵਾਈ ਸੀ ਬਹੁਤ ਸਾਰੇ ਲੋਕਾਂ ਸਕੂਲਾਂ ਦੇ ਕੋਲੇਜਾਂ ਦੇ ਬੱਚਿਆਂ ਨੇ ਭਾਗ ਲਿਆ ਸੀ ਕਈ ਵਾਰ ਪ੍ਰਸ਼ਾਸਨ ਨੂੰ ਬਾਹਰਲੇ ਜ਼ਿਲ੍ਹਿਆ ਦੇ ਪੁਲਿਸ ਵੀ ਅਤੇ ਹੋਰ ਪੋਨ ਕਰਨ ਲਈ ਸਹਾਇਤਾ ਲੈਣੀ ਪੈਂਦੀ ਹੈ ਰਾਸ਼ਟਰੀਏ ਸਮਾਗਮ ਹਨ ਜਿਵੇਂ ਕਿ ਛੱਬੀ ਜਨਵਰੀ ਪੰਦਰਾਂ ਅਗਸਤ ਇਹ ਇਸ ਸਮੇਂ ਜਿਹੜੇ ਸਾਡੇ ਐੱਮ ਐੱਲ ਏ ਲੋਕਲ ਐੱਮ ਐੱਲ ਏ ਜਾਂ ਫਿਰ ਐੱਮ ਪੀ ਹੁੰਦੇ ਹਨ ਉਹ ਸਥਾਨਕ ਸਥਿਤ ਸਟੇਡੀਮਾਂ ਅਤੇ ਗਰਾਊਂਡਾਂ ਦੇ ਵਿੱਚ ਝੰਡੇ ਲਹਿਰਾਉਂਦੇ ਹਨ ਇਹਨਾਂ ਸਮਾਗਮਾਂ ਦੇ ਵਿੱਚ ਸਕੂਲ ਦੇ ਬੱਚੇ ਭਾਗ ਲੈਂਦੇ ਹਨ ਸ ਸਥਾਨਕ ਲੋਕ ਵੀ ਆਉਂਦ ਦੇਖਣ ਆਉਂਦੇ ਹਨ ਕਈ ਵਾਰ ਸੈਮੀਨਾਰ ਕਰਵਾਉਣਾ ਹੋਵੇ ਤਾਂ ਜ਼ਿਲ੍ਹਾ ਪ੍ਰਸ਼ਾਸਨ ਜਾਂ ਡੀਸੀ ਦੇ ਦਫਤਰ ਦਫ਼ਤਰ ਵਲੋਂ ਸਕੂਲ ਜਾਂ ਕਾਲਜ ਦੇ ਔਡੀਟੋਰੀਅਮ ਦੇ ਵਿੱਚ ਕਰਵਾਉਣਾ ਪੈਂਦਾ ਹੈ ਉੱਥੇ ਬਹੁਤ ਸਾਰੇ ਲੋਕਲ ਜਥੇਬੰਦੀਆਂ ਦੇ ਉੱਘੇ ਵਿਅਕਤੀ ਆਗੂ ਦੇ ਹੋਰ ਸਥਾਨਿਕ ਲੋਕ ਅਤੇ ਬੱਚੇ ਆਉਂਦੇ ਹਨ ਸਕੂਲਾਂ ਅਤੇ ਕੋਲੇਜਾਂ ਦੇ ਅਧਿਆਪਕ ਸਾਹਿਬਾਨ ਅਤੇ ਪ੍ਰਿੰਸੀਪਲ ਵੀ ਭਾਗ ਲੈਂਦੇ ਹਨ